ਪੰਜਾਬ ਦੇ ਇੱਕ ਬਹੁਤ ਪ੍ਰਸਿੱਧ ਨਾਮਬਰ ਲੇਖਕ ਜਿਹਨਾਂ ਦਾ ਨਾਮ ਹੈ ਨਰਿੰਦਰ ਸਿੰਘ ਕਪੂਰ ਮੈਂ ਆਪਣੀ ਜ਼ਿੰਦਗੀ ਦੀ ਪਹਿਲੀ ਕਿਤਾਬ ਦਰ ਦਰਵਾਜ਼ੇ ਜੋ ਕਿ ਇਹਨਾਂ ਦੁਆਰਾ ਹੀ ਲਿਖੀ ਹੋਈ ਪੜ੍ਹੀ ਸੀ ਉਹਨਾਂ ਦੀਆਂ ਕਿਤਾਬਾਂ ਮਾਰਕੀਟ ਵਿੱਚ ਬਹੁਤ ਹੀ ਮਸ਼ਹੂਰ ਹਨ ਜਿਹਨਾਂ ਦਾ ਨਾਮ ਹੈ ਦਰ ਦਰਵਾਜ਼ੇ ਖਿੜਕੀਆਂ ਅਤੇ ਅਨਹੋਣੀ ਇਹ ਕਿਤਾਬਾਂ ਬਹੁਤ ਜ਼ਿਆਦਾ ਮਕਬੂਲ ਹੋਈਆਂ ਹਨ ਹਾਲਾਂ ਕਿ ਕਈ ਕਾਲਜਾਂ ਵਿੱਚ ਤਾਂ ਸਿਲੇਬਸ ਵਿੱਚ ਵੀ ਉਹਨਾਂ ਦੀ ਕਿਤਾਬਾਂ ਲਗਦੀਆਂ ਹਨ ਅਤੇ ਉਹਨਾਂ ਨੂੰ ਕਈ ਪੰਜਾਬ ਵੱਲੋਂ ਪੁਸ ਪੁਰਸਕਾਰ ਵੀ ਮਿਲੇ ਹਨ ਅਤੇ ਉਹਨਾਂ ਬਾਰੇ ਮੈਨੂੰ ਬਹੁਤ ਸਾਰੀਆਂ ਗੱਲਾਂ ਪਸੰਦ ਹਨ ਜਿਵੇਂ ਕਿ ਉਹਨਾਂ ਦਾ ਸਾਦਾ ਜੀਵਨ ਅਤੇ ਬਹੁਤ ਸਾਦੀਆਂ ਗੱਲਾਂ ਜੋ ਕਿ ਅਸੀਂ ਨਿੱਜੀ ਜੀਵਨ ਵਿੱਚ ਵੀ ਕਰਦੇ ਰਹਿੰਦੇ ਹਾਂ ਉਹ ਛੋਟੀ ਛੋਟੀ ਗੱਲਾਂ ਨੂੰ ਇੰਨਾਂ ਬਾਖੂਬੀ ਲਿਖਦੇ ਹਨ ਕਿ ਸਾਹਮਣੇ ਪੜ੍ਹਨ ਵਾਲਾ ਜੇਕਰ ਆਪਾਂ ਉਸ ਦੀ ਗੱਲ ਕਿਸੇ ਦਸ ਪੜ੍ਹੇ ਨੂੰ ਵੀ ਸਮਝਾਈਏ ਉਹ ਵੀ ਬੜੇ ਅੱਛੇ ਤਰੀਕੇ ਨਾਲ ਸਮਝ ਕੇ ਜ਼ਿੰਦਗੀ ਵਿੱਚ ਲਾਗੂ ਕਰਨ ਦੇ ਹੋਣਹਾਰ ਬਣ ਸਕਦਾ ਹੈ ਅਤੇ ਮੈਂ ਵਿਅਕਤੀਤਵ ਤੌਰ 'ਤੇ ਉਹਨਾਂ ਨੂੰ ਬਹੁਤ ਪਸੰਦ ਕਰਦਾ ਹਾਂ ਜ਼ਿੰਦਗੀ ਵਿੱਚ ਮੈਂ ਉਹਨਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਇੱਕ ਵਾਰ ਮਿਲਿਆ ਵੀ ਸੀ ਅਤੇ ਮੈਂ ਉਹਨਾਂ ਨੂੰ ਆਪਣੀ ਗਜ਼ਲ ਸੁਣਾਈ